ਮੈਂ ਸਿੱਖ ਧਰਮ ਨਾਲ ਸੰਬੰਧ ਰੱਖਦਾਂ ਅਤੇ ਸਾਡਾ ਧਰਮ ਟੋਟਲੀ ਸਿੱਖਿਆ ਹੀ ਇਹੀ ਦਿੰਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਿਚਿ ਦੁਨੀਆ ਸੇਵ ਕਮਾਈਐ ਤਾ ਦਰਗਹ ਬੈਸਣੁ ਪਾਈਐ ਸਾਡਾ ਸਿਧਾਂਤ ਹੀ ਇਹੀ ਹੈ ਕਿ ਜੇ ਦੁਨੀਆਂ ਦੇ ਵਿੱਚ ਰਹਿ ਕੇ ਸੇਵਾ ਕਰਨੀ ਏ ਸੇਵਾ ਕਰੇਂਗਾ ਤਾਂ ਤੈਨੂੰ ਅਗਲੀ ਦਰਗਾਹ ਦੇ ਵਿੱਚ ਸਤਿਕਾਰ ਮਿਲੇਗਾ ਸਾਡਾ ਸਮੁੱਚਾ ਫਲਸਫਾ ਹੀ ਸਾਨੂੰ ਸੇਵਾ ਦੀ ਭਾਵਨਾ ਦੇ ਵਿੱਚ ਨਿਪੁੰਨ ਕਰਦਾ ਨਿਮਰਤਾ ਦੇ ਵਿੱਚ ਰਹਿ ਕੇ ਸੇਵਾ ਸਿਮਰਨ ਦੇ ਨਾਲ ਜੁੜਨਾ ਗੁਰੂ ਨਾਨਕ ਦੇਵ ਜੀ ਦੇ ਤਿੰਨ ਸਿਧਾਂਤ ਨਾਮ ਜਪੋ ਕਿਰਤ ਕਰੋ ਅਤੇ ਵੰਡ ਛਕੋ ਵੰਡ ਛਕੋ ਦਾ ਜਿਹੜਾ ਤੀਸਰਾ ਸਿਧਾਂਤ ਆ ਉਹ ਕਿਰਤ ਕਰਕੇ ਵੰਡ ਕੇ ਛਕਣਾ ਭਾਵ ਸੇਵਾ ਕਰਨੀ ਲੋੜਵੰਦਾਂ ਦੀ ਲੋੜ ਦੀ ਪੂਰਤੀ ਕਰਨੀ ਜਿਹਨੂੰ ਕਿਸੇ ਨੂੰ ਲੋੜ ਆ ਉਹਦੀ ਲੋੜ ਦੀ ਪੂਰਤੀ ਕਰਨੀ ਤਾਂ ਦੁਨੀਆਂ ਦੇ ਇਤਿਹਾਸ ਦੇ ਵਿੱਚ ਜਦੋਂ ਵੀ ਕਿਤੇ ਹੁਣ ਜਦੋਂ ਦਾ ਸਿੱਖ ਧਰਮ ਹੋਂਦ ਦੇ ਵਿੱਚ ਆਇਆ ਜਦੋਂ ਵੀ ਕਿਤੇ ਮੁਸ਼ਕਿਲ ਆਈ ਏ ਆਫਤ ਆਈ ਏ ਅਤੇ ਇਸ ਧਰਮ ਦੇ ਪੈਰੋਕਾਰਾਂ ਨੇ ਵੱਧ ਚੜ੍ਹ ਕੇ ਆਪਣਾ ਹਿੱਸਾ ਪਾਇਆ ਅਤੇ ਸਾਡੇ ਧਰਮ ਦਾ ਜਿਹੜਾ ਅਭਿਆਸ ਆ ਉਹ ਨਿਰੰਤਰ ਹੀ ਆ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਨੂੰ ਚੇਤੇ ਵਿੱਚ ਰੱਖਣਾ ਕਿਰਤ ਕਮਾਈ ਕਰਦਿਆਂ ਵੀ ਜੋ ਵੀ ਆਪਣਾ ਕਿਰਤ ਆ ਮਿਹਨਤ ਆ ਉਹ ਕਰ ਵੀ ਰਹੇ ਆ ਅਤੇ ਤਾਂ ਵੀ ਉਹਨੂੰ ਯਾਦ ਵਿੱਚ ਰੱਖਣਾ ਉਹਨੂੰ ਚੇਤੇ ਵਿੱਚ ਰੱਖ ਕੇ ਸੱਚੀ ਸੁੱਚੀ ਕਿਰਤ ਦੇ ਨਾਲ ਜੁੜਨਾ ਇਹ ਸਾਨੂੰ ਸਿੱਖਿਆ ਦਿੱਤੀ ਜਾਂਦੀ ਆ ਅਤੇ ਸਮਾਜ ਸੇਵਾ ਦੇ ਕਿਹੜੇ ਤਰੀਕੇ ਬਹੁਤ ਸਾਰੇ ਤਰੀਕੇ ਨੇ ਜਿਵੇਂ ਲੰਗਰ ਪ੍ਰਥਾ ਏ ਸਾਡੇ ਅੰਦਰ ਹਰੇਕ ਗੁਰ ਅਸਥਾਨ ਦੇ ਅੰਦਰ ਜਿਹੜੇ ਵੀ ਧਾਰਮਿਕ ਅਸਥਾਨ ਨੇ ਸਾਡੀ ਇਤਿਹਾਸਿਕ ਅਸਥਾਨ ਨੇ ਉਹਨਾਂ ਦੇ ਅੰਦਰ ਨਿਰੰਤਰ ਲੰਗਰ ਦੀ ਜਿਹੜੀ ਪ੍ਰਥਾ ਉਹ ਚੱਲਦੀ ਰਹਿੰਦੀ ਹੈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਣ ਕੇ ਪ੍ਰਸ਼ਾਦਾ ਛਕਦੀਆਂ ਨੇ ਬਿਨਾਂ ਕਿਸੇ ਭੇਦ ਭਾਵ ਤੋਂ ਊਚ ਨੀਚ ਤੋਂ ਕਿਸੇ ਵੀ ਕੋਈ ਜਾਤ ਦੇ ਨਾਲ ਸੰਬੰਧ ਰੱਖਦਾ ਕੋਈ ਮਾਇਨੇ ਨਹੀਂ ਰੱਖਦਾ ਕੋਈ ਉੱਚਾ ਕੋਈ ਨੀਵਾਂ ਕੋਈ ਅਮੀਰ ਹੈ ਕੋਈ ਗਰੀਬ ਹੈ ਕੋਈ ਨੀਵੀਂ ਜਾਤ ਦੇ ਨਾਲ ਸੰਬੰਧ ਰੱਖ ਰਿਹਾ ਕੋਈ ਵੱਡੀ ਜਾਤ ਨਾਲ ਜਿਹੜੇ ਲੋਕਾਂ ਨੇ ਬਣਾਈਆਂ ਹੋਈਆਂ ਨੇ ਸਿੱਖ ਧਰਮ ਦੇ ਵਿੱਚ ਐਸੀ ਕੋਈ ਬੰਦਿਸ਼ ਨਹੀਂ ਆ ਹਰ ਕੋਈ ਇਕੱਠੇ ਮਿਲ ਬੈਠ ਕੇ ਪ੍ਰਸ਼ਾਦਾ ਛਕਦੇ ਨੇ ਇਹ ਸਾਰੀ ਸੇਵਾ ਦੀ ਭਾਵਨਾ ਸਾਨੂੰ ਸਿੱਖ ਇਤਿਹਾਸ ਸਿੱਖ ਧਰਮ ਸਿੱਖ ਧਰਮ ਦਾ ਜਿਹੜਾ ਫਲਸਫਾ ਏ ਗੁਰਬਾਣੀ ਹੈ ਉਹ ਸਾਨੂੰ ਸਿਖਾਉਂਦੀ ਹੈ